ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਪਰਸਨਲ ਐਜ ਏ ਪਰਸਨਲ ਸੈੱਫ ਕੰਮ ਕਰਦੇ ਹਾਂ ਘਰਾਂ ਵਿੱਚ ਜੇ ਕਿਸੇ ਨੇ ਮੀਲ ਵਗੈਰਾ ਆਪਣੀ ਬਣਵਾਉਣੀ ਹੈ ਜਾਂ ਕਿਸੇ ਦੇ ਘਰ ਕੋਈ ਗੈਸਟ ਵਗੈਰਾ ਆਏ ਉਹਨਾਂ ਨੇ ਡਿਸ਼ ਵਗੈਰਾ ਪ੍ਰਪੇਅਰ ਕਰਵਾਉਣੀ ਹੈ ਤਾਂ ਤੁਸੀਂ ਸਾਡੀ ਹੈਲਪ ਲੈ ਸਕਦੇ ਹੋ ਅਸੀਂ ਹਾਜ਼ਰ ਹਾਂ ਤੁਹਾਡੇ ਵਾਸਤੇ ਹਾਂਜੀ ਸਪੈਸ਼ਲ ਦੇ ਵਿੱਚ ਜਿਵੇਂ ਡਿਸ਼ਿਸ ਸਵੀਟ ਡਿਸ਼ੀਸ ਵੀ ਬਣਾ ਲੈਂਦੇ ਹਾਂ ਅਸੀਂ ਗਜਰੇਲਾ ਵਗੈਰਾ ਹੋ ਗਏ ਜਾਂ ਖੀਰ ਵਗੈਰਾ ਹੋ ਗਈ ਜਾਂ ਹੋਰ ਬਹੁਤ ਕੁਛ ਜਿਵੇਂ ਸਾਊਥ ਦੇ ਏਰੀਆ ਵੱਲ ਉੱਧਰ ਦੇ ਡਿਸ਼ੀਸ ਇਡਲੀ ਡੋਸਾ ਸਾਂਬਰ ਜਾਂ ਨੌਰਥ ਦੀਆਂ ਡਿਸ਼ੀਸ ਜਿਵੇਂ ਪੰਜਾਬ ਦਾ ਬਹੁਤ ਮਸ਼ਹੂਰ ਹੈ ਸਾਗ ਤਾਂ ਸਾਗ ਹੋ ਗਿਆ ਮੱਕੀ ਦੀ ਰੋਟੀ ਹੋ ਗਈ ਇਹ ਕੁਛ ਵੀ ਬਣਾ ਲੈਂਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਐਵਲੇਬਲ ਹੈ ਐਵਲੇਬਲ ਹੈ ਜੀ ਅਸੀਂ ਔਰ ਛੇ ਵਜੇ ਤੋਂ ਲੈ ਕੇ ਰਾਤ ਦੇ ਅੱਠ ਵਜੇ ਤੱਕ ਅਸੀਂ ਅਵਲੇਬਲ ਹਾਂ ਤੁਹਾਡੇ ਵਾਸਤੇ ਦੋ ਘੰਟਿਆਂ ਵਾਸਤੇ ਪੂਰੇ ਅਵਲੇਬਲ ਹਾਂ ਅੱਛਾ ਤੁਹਾਨੂੰ ਪੂਰੇ ਦਿਨ ਵਾਸਤੇ ਚਾਹੀਦਾ ਨਹੀਂ ਕੁੱਕ ਤਾਂ ਆਪਾਂ ਇੱਕ ਸਪੈਸੀਫਿਕ ਟਾਈਮ 'ਤੇ ਹੀ ਕਰਾਂਗੇ ਨਾ ਹੁਣ ਸਾਰਾ ਦਿਨ ਤਾਂ ਹਾਂਜੀ ਕੋਈ ਨਹੀਂ ਫੇਰ ਅਸੀਂ ਦੇਖ ਲਵਾਂਗੇ ਤੁਸੀਂ ਦੱਸ ਦਿਉ ਕਿਵੇਂ ਕੀ ਕੁਛ ਕੰਡੀਸ਼ਨਸ ਨੇ ਤੁਹਾਡੀਆਂ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਓਕੇ ਓਕੇ ਮੈਮ ਖਿਚੜੀ ਵਗੈਰਾ ਖਿਚੜੀ ਦਲੀਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਮ ਹਾਂਜੀ ਜਿਵੇਂ ਉਹ ਤੁਹਾਡੇ ਜਿਵੇਂ ਉਹ ਪੇਰੈਂਟਸ ਆ ਜਿਵੇਂ ਖਿਚੜੀ ਹੋ ਗਈ ਦਾਲ ਹਲਕੀ ਫੁਲਕੀ ਦਾਲ ਇੱਦਾਂ ਦੀ ਚੀਜ਼ਾਂ ਹੀ ਖਾਣਗੇ ਹਾਂਜੀ ਨਹੀਂ ਨਹੀਂ ਨੈਚੁਰਲ ਆਪਾਂ ਯੂਜ ਕਰਾਂਗੇ ਜਿਵੇਂ ਸ਼ੱਕਰ ਵਗੈਰਾ ਹੀ ਯੂਜ ਕਰਾਂਗੇ ਸਵੀ ਸਵੀਟ ਡਿਸ਼ੀਸ ਜਰਨਲੀ ਦੋ ਤਿੰਨ ਦਿਨਾਂ ਮਗਰੋਂ ਹੀ ਆਪਾਂ ਬਣਾ ਲਿਆ ਕਰਾਂਗੇ ਉਹ ਤਾਂ ਕੋਈ ਦਿੱਕਤ ਨਹੀਂ ਉਹਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਆਵਾਂਗੇ ਜੀ ਓਕੇ ਮੈਮ ਓਕੇ ਮੈਮ ਥੈਂਕ ਯੂ ਮੈਮ